ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਾਡੇ ਪਠਾਨਕੋਟ ਬਹੁਤ ਸਾਰੀਆਂ ਜਗ੍ਹਾ ਜਿੱਥੇ ਮਰਜ਼ੀ ਘੁੰਮ ਲਓ ਤੁਸੀਂ ਤੁਸੀਂ ਤੁਸੀਂ ਕਿੱਥੇ ਘੁੰਮਣਾ ਚਾਹੁੰਦੇ ਹੋ ਸਾਡੇ ਲੋਕਲ ਇੱਕ ਜਗ੍ਹਾ ਤਾਂ ਕਾਫੀ ਹੈ ਜਿਸ ਤਰ੍ਹਾਂ ਮਿਨੀ ਗੋਆ ਹੈ ਨੂਰਪੁਰ ਕਿਲ੍ਹਾ ਹੈ ਹੋਰ ਵੀ ਕਿੰਨੀਆਂ ਸਾਰੀਆਂ ਜਗ੍ਹਾ ਹੈ ਜਿੱਥੇ ਮਰਜ਼ੀ ਚਲ ਜਾਓ ਵਿਸ਼ਾਲ ਮੈਗਾ ਮਾਰਟ ਹਾਂਜੀ ਹਾਂਜੀ ਮੋਲ ਵੀ ਸਾਡੇ ਕਾਫੀ ਹੈ ਜਿੰਨੇ ਮਰਜ਼ੀ ਘੁੰਮੋ ਮੋਲ ਸਾਡੇ ਤੋਂ ਹੋਣਾ ਥੋੜ੍ਹਾ ਦੂਰ ਇੱਥੋਂ ਅੱਧ ਅੱਧੇ ਕੁ ਘੰਟੇ ਦਾ ਲਾ ਲਓ ਰਸਤਾ ਹਾਂਜੀ ਸਾਡੇ ਖਾਣ ਨੂੰ ਸਾਡੇ ਡੋਸ਼ਾ ਡੋਸਾ ਮਸ਼ਹੂਰ ਹੈ ਹਾਂਜੀ ਪਾਓ ਭਾਜੀ ਵੀ ਮਸ਼ਹੂਰ ਆ ਉਹਨਾਂ ਦੀ ਉਹ ਤੁਸੀਂ ਖਾ ਸਕਦੇ ਹੋ ਔਰ ਇਸ ਤੋਂ ਇਲਾਵਾ ਜੋ ਤੁਹਾਨੂੰ ਪਸੰਦ ਆ ਹਰ ਇੱਕ ਚੀਜ਼ ਮਿਲ ਜੂਗੀ ਹਾਂਜੀ ਸਭ ਕੁਝ ਮਿਲ ਜਾਂਦਾ ਜੀ ਜੋ ਤੁਸੀਂ ਖਾਣਾ ਚਾਹੁੰਦੇ ਹੋ ਸਭ ਕੁਝ ਮਿਲ ਜਾਂਦਾ ਹਾਂਜੀ ਹਾਂਜੀ ਸਾਡੇ ਜਿੱਦਾਂ ਮਰਜ਼ੀ ਘੁੰਮੋ ਫਿਰੋ ਫੁੱਲ ਇੰਜੋਏ ਕਰੋ ਠੀਕ ਹੈ ਜੀ ਓਕੇ ਜੀ